ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਡਾਂਸ ਗਰੁੱਪ ਜਾਂ ਡਾਂਸ ਪ੍ਰਦਰਸ਼ਨ ਬਾਰੇ ਡਾਂਸ ਸਿਰਫ ਇੱਕ ਮਨੋਰੰਜਨ ਦਾ ਸਾਧਨ ਹੀ ਨਹੀਂ ਆ ਇਹ ਸ ਨਾਲ ਨਾਲ ਇੱਕ ਸਰੀਰਕ ਤੰਦਰੁਸਤੀ ਦਾ ਸਾਧਨ ਵੀ ਆ ਬਹੁਤ ਵਧੀਆ ਐਕਸਰਸਾਈਜ਼ ਆ ਸਾਡੇ ਨਜ਼ਦੀਕ ਕੋਚ ਸਰ ਗੁਰਪ੍ਰੀਤ ਕੋਚ ਸਾਹਿਬ ਨੇ ਮਾਲਵਾ ਭੰਗੜਾ ਗਰੁੱਪ ਹੈ ਉਹਨਾਂ ਦੇ ਕੋਚ ਸਾਹਿਬ ਨੇ ਉਹ ਭੰਗੜਾ ਸ਼ੁਰੂ ਕਰਾਉਣ ਤੋਂ ਪਹਿਲਾਂ ਸਾਨੂੰ ਇੱਕ ਗਰਾਊਂਡ ਦਾ ਚੱਕਰ ਜ਼ਰੂਰ ਲਵਾਇਆ ਕਰਦੇ ਜੀ ਅਸੀਂ ਉਹਨਾਂ ਨੂੰ ਪੁੱਛਦੇ ਵੀ ਆਪਾਂ ਕਰਨਾ ਤਾਂ ਭੰਗੜਾ ਹੀ ਆ ਗਰਾਊਂਡ ਦਾ ਚੱਕਰ ਕਿਉਂ ਉਹ ਕਹਿੰਦੇ ਵੀ ਭੰਗੜਾ ਸਿਰਫ ਭੰਗੜਾ ਹੀ ਨਹੀਂ ਆ ਨਾਲ ਨਾਲ ਸਰੀਰਕ ਤੰਦਰੁਸਤੀ ਵੀ ਜ਼ਰੂਰੀ ਆ ਜੇਕਰ ਸਰੀਰ ਤੰਦਰੁਸਤ ਹੋਵੇਗਾ ਤਾਂ ਹੀ ਅਸੀਂ ਭੰਗੜਾ ਚੰਗੀ ਤਰੀਕੇ ਨਾਲ ਭੰਗੜਾ ਪਾ ਸਕਾਂਗੇ ਠੀਕ ਹੈ ਜੀ ਬਿਲਕ ਉਹਨਾਂ ਦੀ ਗੱਲ ਕਹੀਆਂ ਹੋਈਆਂ ਗੱਲਾਂ ਹੁਣ ਸਮਝ ਆ ਰਹੀਆਂ ਨੇ ਕਿਉਂਕਿ ਅੱਜ ਕੱਲ੍ਹ ਦੇ ਜੋ ਰੁਝੇਵੇਂ ਨੇ ਉਹ ਐਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਅਸੀਂ ਆਪਣੀ ਸਿਹਤ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਉਹ ਨਾਲ ਇੱਕ ਗੱਲ ਵੀ ਕਹਿੰਦੇ ਹੁੰਦੇ ਸੀ ਵੀ ਬੇਸ਼ੱਕ ਤੁਸੀਂ ਪ੍ਰੋਫੈਸ਼ਨਲ ਤੌਰ 'ਤੇ ਭੰਗੜਾ ਨਾ ਪਾਓ ਪਰ ਇੱਕ ਘੰਟਾ ਅੱਧਾ ਘੰਟਾ ਜਿੰਨਾ ਵੀ ਸਮਾਂ ਤੁਸੀਂ ਕੱਢ ਸਕਦੇ ਹੋ ਸਾਡੇ ਕੋਲ ਆਓ ਅਤੇ ਭੰਗੜਾ ਕਰੋ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਭੰਗੜਾ ਕਰਾਉਣਾ ਭੰਗੜਾ ਸਿਖਾਉਣਾ ਨਹੀਂ ਸੀਗਾ ਉਹਨਾਂ ਦਾ ਮਕਸਦ ਸੀ ਕਿ ਜੋ ਵੀ ਬੰਦਾ ਉਹਨਾਂ ਨਾਲ ਜੁੜੇ ਉਹ ਸਰੀਰਕ ਤੌਰ 'ਤੇ ਵੀ ਤੰਦਰੁਸਤ ਰਹੇ ਉਹ ਇਸੇ ਤਰ੍ਹਾਂ ਹੀ ਵੱਖ ਵੱਖ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਭੰਗੜੇ ਦੇ ਮਨੋਰੰਜਨ ਦੇ ਨਾਲ ਨਾਲ ਸਰੀਰਕ ਤੰਦਰੁਸਤੀ ਦੇ ਫਾਇਦੇ ਦੱਸ ਕੇ ਵੀ ਬੱਚਿਆਂ ਨੂੰ ਭੰਗੜੇ ਲਈ ਉਤਸ਼ਾਹਿਤ ਕਰਦੇ ਨੇ ਉਹਨਾਂ ਨੂੰ ਵੇਖ ਕੇ ਕਾਫੀ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨਾਲ ਜੁੜੇ ਹੋਏ ਨੇ ਜੋ ਭੰਗੜਾ ਕਰ ਰਹੇ ਨੇ ਉਹ ਸਿਰਫ ਉਹਨਾਂ ਵਿੱਚੋਂ ਕੁਝ ਕ ਗਿਣਤੀ ਦੇ ਹੀ ਬੱਚੇ ਨੇ ਜੋ ਸਟੇਜਾਂ 'ਤੇ ਜਾ ਕੇ ਪ੍ਰਦਰਸ਼ਨ ਕਰਦੇ ਨੇ ਪਰ ਜ਼ਿਆਦਾਤਰ ਬੱਚੇ ਜੋ ਉਹਨਾਂ ਨਾਲ ਜੁੜੇ ਹੋਏ ਨੇ ਉਹ ਸਰੀਰਕ ਤੰਦਰੁਸਤੀ ਕਰਕੇ ਜੁੜੇ ਹੋਏ ਨੇ ਠੀਕ ਹੈ ਜੀ ਭੰਗੜਾ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ ਨਾਲ ਨਾਲ ਇਹ ਸਾਡੇ ਲਈ ਸਰੀਰਕ ਤੰਦਰੁਸਤੀ ਦਾ ਵੀ ਸਾਧਨ